ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਪ੍ਰੀਤ ਸਿੰਘ ਬੋਲਦਾ ਹਾਂ ਕੀ ਤੁਸੀਂ ਅਮਨ ਟਰੈਵਲਰ ਤੋਂ ਬੋਲਦੇ ਹਨ ਹਾਂਜੀ ਮੈਂ ਰਾਤ ਨੂੰ ਇੱਕ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਤੱਕ ਦੇ ਪਿੱਕੁ ਬੁੱਕ ਕਰਵਾਈ ਸੀਗੀ ਅਤੇ ਮੈਂ ਚੰਡੀਗੜ੍ਹ ਜਾਣਾ ਸੀਗਾ ਜੀ ਏਅਰਪੋਰਟ ਵਾਸਤੇ ਜੀ ਅਤੇ ਮੈਂ ਮੈਨੂੰ ਆਪਣਾ ਐਡਰੈੱਸ ਟਿਕਾਣਾ ਚੇਂਜ ਕਰਨਾ ਪੈਂਡਿਆ ਕਿਉਂਕਿ ਮੈਂ ਰਾਤ ਨੂੰ ਰੋਪੜ ਆ ਗਿਆ ਸੀਗਾ ਜੀ ਸਾਡਾ ਰਿਸ਼ਤੇਦਾਰ ਬਿਮਾਰ ਹੋ ਗਿਆ ਸੀ ਜਿਸ ਕਾਰਨ ਮੈਂ ਰੋਪੜ ਆ ਗਿਆ ਅਤੇ ਹੁਣ ਤੁਸੀਂ ਮੈਨੂੰ ਰੋਪੜ ਤੋਂ ਚੰਡੀਗੜ੍ਹ ਤੱਕ ਵਾਸਤੇ ਪਿੱਕ ਕਰਨਾ ਹੈ ਜੀ ਅਤੇ ਮੈਂ ਅਗਰ ਜੇਕਰ ਤੁਹਾਨੂੰ ਫੇਰ ਵੀ ਨਹੀਂ ਪਤਾ ਲੱਗਿਆ ਫੇਰ ਮੈਂ ਤੁਹਾਨੂੰ ਆਪਣੇ ਵਟਸਐਪ 'ਤੇ ਲੋਕੇਸ਼ਨ ਭੇਜ ਦੂਗਾ ਜੇਕਰ ਤੁਹਾਨੂੰ ਕੋਈ ਹੋਰ ਖੇਚਲ ਹੋਈ ਤਾਂ ਉਹਦੇ ਕਰਕੇ ਮੈਂ ਮਾਫੀ ਚਾਹੁੰਦਾ ਹਾਂ ਅਤੇ ਮੈਂ ਤੁਹਾਡਾ ਵੇਟ ਕਰਦਾ ਹਾਂ ਤੁਸੀਂ ਜਲਦੀ ਤੋਂ ਜਲਦੀ ਮੇਰੇ ਤੱਕ ਪਹੁੰਚ ਜਾਉ ਤਾਂ ਕਿ ਸਾਨੂੰ ਰਸਤੇ 'ਚ ਟ੍ਰੈਫਿਕ ਨਾ ਮਿਲੇ ਅਤੇ ਹੋਰ ਕੋਈ ਮਤਲਬ ਜੇ ਕੋਈ ਖੇਚਲ ਹੈ ਤਾਂ ਮੈਂ ਉਹਦੇ ਕਰਕੇ ਤੁਹਾਡੇ ਤੋਂ ਮਾਫੀ ਮੰਗ ਲਉਂਗਾ ਅਤੇ ਤੁਸੀਂ ਛੇਤੀ ਛੇਤੀ ਮੇਰੇ ਤੱਕ ਪਹੁੰਚ ਜਾਉ ਚਲੋ ਠੀਕ ਹੈ ਜੀ ਧੰਨਵਾਦ